ਹੈਲੋ ਹਾਂਜੀ ਸਰ ਐਚ ਡੀ ਐਫ ਸੀ ਸਿਕਿਉਰਿਟੀਜ ਤੋਂ ਰਾਜੀਵ ਜੀ ਗੱਲ ਕਰ ਰਹੇ ਹੋ ਹਾਂਜੀ ਸਰ ਮੈਂ ਡਾਕਟਰ ਡੀ ਸਿੰਘ ਬੋਲ ਰਿਹਾ ਸੀ ਅਤੇ ਮੈਂ ਕੁਛ ਦਿਨ ਪਹਿਲਾਂ ਹੀ ਰਿਟਾਇਰ ਹੋਇਆ ਸੀ ਅਤੇ ਰਿਟਾਇਰਮੈਂਟ 'ਤੇ ਮੈਨੂੰ ਕੁਛ ਪੈਸਾ ਮਿਲਿਆ ਸੀਗਾ ਅਤੇ ਮੈਂ ਹੁਣ ਉਸ ਨੂੰ ਨਮਸਕਾਰ ਸਰ ਮੈਂ ਹੁਣ ਸ਼ੇਅਰ ਮਾਰਕੀਟ ਦੇ ਵਿੱਚ ਕੁਛ ਸ਼ੇਅਰ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਸੋਚ ਰਿਹਾ ਸੀਗਾ ਅਤੇ ਅਤੇ ਅਤੇ ਸਰ ਤੁਸੀਂ ਮੈਨੂੰ ਗਾਈਡ ਕਰ ਸਕਦੇ ਹੋ ਕਿ ਕਿਹੜੇ ਕਿਹੜੇ ਸੈਕਟਰਜ਼ ਅਲੱਗ ਅਲੱਗ ਅੱਜ ਕੱਲ੍ਹ ਚੱਲ ਰਹੇ ਆ ਅਤੇ ਜਿਨ੍ਹਾਂ ਵਿੱਚ ਇਨਵੈਸਟਮੈਂਟ ਆਪਾਂ ਕਰ ਸਕਦੇ ਹਾਂ ਹਾਂਜੀ

ਬਿਲਕੁਲ

ਠੀਕ ਹੈ ਅਤੇ ਸਰ ਲਾਸਟ ਤੁਹਾਡੀ ਕੀ ਦੋ ਰਿਕਮੈਂਡੇਸ਼ਨ ਮੈਨੂੰ ਦੱਸ ਦਿਓ ਜੇ ਮੈਂ ਕੋਈ ਦੋ ਸੈਕਟਰਸ ਦੇ ਵਿੱਚ ਫੋਕਸ ਕਰਨਾ ਤਾਂ ਕਿਹਦੇ ਕਿਹਦੇ ਵਿੱਚ ਕਰ ਸਕਦਾ ਮੈਂ ਹਾਂਜੀ ਹਾਂਜੀ

ਹਾਂਜੀ ਅਤੇ ਠੀਕ ਹੈ

ਅਤੇ ਸਰ ਸੈਕਟਰ ਵਾਈਜ਼ ਤੁਹਾਡੀ ਕੀ ਰਿਕਮੈਂਡੇਸ਼ਨ ਰਹੇਗੀ ਐਲੋਕੇਸ਼ਨ ਜੇ ਆਪਾਂ ਕਹੀਏ ਕਿੰਨੇ ਕਿੰਨੇ ਪਰਸੈਂਟ ਠੀਕ ਹੈ

ਠੀਕ ਹੈ ਠੀਕ ਹੈ ਠੀਕ ਹੈ ਸਰ ਮੈਂ ਰਿਕਮੈਂਡੇਸ਼ਨ ਤੁਹਾਡੀਆਂ ਲੈ ਲਈਆਂ ਅਤੇ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ